ਚੋਣਾਂ ਦੌਰਾਨ ਜਾਂ ਕਹਿ ਲਈਏ ਚੋਣਾਂ ਦੇ ਸਮੇਂ ਆਮ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਦਾਂ ਕਿ ਉੱਚੇ ਉੱਚੇ ਲਾਊਡ ਸਪੀਕਰ ਲਗਾ ਦਿੰਦੇ ਹਨ ਇਹ ਜ਼ਿਆਦਾਤਰ ਮਾਰ ਕਰਦਾ ਬਜ਼ੁਰਗ ਅਤੇ ਬੱਚਿਆਂ ਦੇ ਲਈ ਕਿ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਲਾਊਡ ਸਪੀਕਰ ਲਗਾਏ ਹੁੰਦੇ ਹਨ ਉਹ ਤੇਜ਼ ਆਵਾਜ਼ਾਂ ਸੁਣ ਕੇ ਉਹਨਾਂ ਦੇ ਦਿਮਾਗੀ ਸੰਤੁਲਨ ਖਰਾਬ ਹੁੰਦਾ ਹੈ ਅਤੇ ਚੋਣਾਂ ਦੌਰਾਨ ਇੰਨਾਂ ਜ਼ਿਆਦਾ ਭੀੜ ਭੜੱਕਾ ਹੁੰਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਜ਼ਿਆਦਾਤਰ ਨਸ਼ਿਆਂ ਦੇ ਪਾਸੇ ਪਾਰਟੀਆਂ ਲਗਾ ਕੇ ਉਹਨਾਂ ਦੇ ਵਿੱਚ ਜਾਤ ਪਾਤ ਦਾ ਅਤੇ ਕੁਛ ਹੋਰ ਐਸੇ ਸ਼ਰਾਰਤੀ ਅਨਸਰ ਪੈਦਾ ਕਰ ਦਿੱਤੇ ਜਾਂਦੇ ਹਨ ਜੋ ਕਿ ਨੌਜਵਾਨ ਪੀੜ੍ਹੀ ਉਹ ਗਲਤ ਪਾਸੇ ਨੂੰ ਤੁਰਦੀ ਆ ਨਸ਼ਿਆਂ ਕਨ੍ਹੀ ਤੁਰਦੀ ਹੈ ਜਿਹਦੇ ਨਾਲ ਉਹਨਾਂ ਦਾ ਪਰਿਵਾਰ ਖਰਾਬ ਹੁੰਦਾ ਹੈ